ਹੈਲੋ ਸਰ ਸਤਿ ਸ਼੍ਰੀ ਕਾਲ ਮੈਂ ਨਾ ਤੁਹਾਡੇ ਕੋਲ ਦਸ ਦਿਨ ਪਹਿਲਾਂ ਆਪਣਾ ਆਧਾਰ ਅਪਡੇਟ ਕਰਵਾਉਣ ਆਇਆ ਸੀ ਦਰਅਸਲ ਮੇਰਾ ਨਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਸੀ ਅਤੇ ਹੁਣ ਜਦੋਂ ਮੈਂ ਚੈੱਕ ਕੀਤਾ ਤੁਹਾਡੀ ਆਧਾਰ ਕਾਰਡ ਦੀ ਵੈਬਸਾਈਟ 'ਤੇ ਜਾ ਕੇ ਇਹ ਫਿਰ ਵੀ ਐਵੇਂ ਹੀ ਦੱਸ ਰਿਹਾ ਕੇ ਨੰਬਰ ਹਜੇ ਲਿੰਕ ਨਹੀਂ ਹੋਇਆ ਕੀ ਤੁਸੀਂ ਇੱਕ ਵਾਰ ਦੁਬਾਰਾ ਜਾਂਚ ਕਰ ਸਕਦੇ ਹੋ ਅਸਲ ਵਿੱਚ ਨਾ ਮੈਨੂੰ ਬੈਂਕ ਵਾਲਿਆਂ ਨੇ ਕਿਹਾ ਹੈ ਕਿ ਤੁਸੀਂ ਨੰਬਰ ਆਪਣਾ ਜਲਦੀ ਤੋਂ ਜਲਦੀ ਅਟੈਚ ਕਰਵਾ ਦਿਓ ਤਾਂ ਜੇ ਤੁਸੀਂ ਵੀ ਮੇਰੀ ਹੈਲਪ ਕਰ ਸਕੋਂ ਤਾਂ ਬਹੁਤ ਵਧੀਆ ਹੋਵੇਗਾ ਜੀ ਧੰਨਵਾਦ